ਹੈਲੋ ਹੈਲੋ ਸਰ ਬਠਿੰਡਾ ਜੰਕਸ਼ਨ ਆਈਆਰਸੀਟੀਸੀ ਤੋਂ ਬੋਲ ਰਹੇ ਹਾਂ ਬੋਲੋ ਕੀ ਕੀ ਕੁਆਇਰੀ ਤੁਹਾਡੀ ਅੱਛਾ ਸਰ ਕਦੋਂ ਕੁ ਕਰਾਈ ਹੈ ਅੱਛਾ ਅੱਛਾ ਅੱਛਾ ਸਰ ਇਹਦੇ 'ਚ ਐਈਂ ਹੈ ਵੀ ਕੀ ਕਹਿੰਦੇ ਤੁਹਾਡਾ ਦੋ ਸੌ ਰੁਪਈਆ ਡਿਡਕਟ ਹੋਜੇਗਾ ਕਿਉਂਕਿ ਜਿਵੇਂ ਸੌ ਰੁਪਏ ਦੀ ਪਰ ਟਿਕਟ ਸੀਗੀ ਅਤੇ ਮੈਂ ਚੈੱਕ ਕੀਤਾ ਕੀ ਕਹਿੰਦੇ ਆ ਅਤੇ ਸੌ ਰੁਪਏ ਦੀ ਪਰ ਟਿਕਟ ਸੀ ਅਤੇ ਫਿਫਟੀ ਪ੍ਰਸੈਂਟ ਉਹ ਡੀਡਕਸ਼ਨ ਹੋਏਗੀ ਹਾਂਜੀ ਸਰ ਇਨਾ ਸਾਡੀ ਪੋਲਸੀ ਸਰ ਰੇਲਵੇ ਦੀ ਪੋਲਸੀ ਹੈਗੀ ਆ ਸਰ ਕੁਛ ਨਹੀਂ ਕੀਤਾ ਜਾ ਸਕਦਾ ਮੈਂ ਵੀ ਕੁਛ ਨਹੀਂ ਕਰ ਸਕਦਾ ਕਿਉਂਕਿ ਸਰ ਤੁਹਾਨੂੰ ਪਤਾ ਮੈਂ ਆਪ ਗੋਰਮੈਂਟ ਦੇ ਅੰਡਰ ਆਨਾ ਆਪਾਂ ਇਹ ਤਾਂ ਹੈ ਨਹੀਂ ਵੀ ਕੋਈ ਮੈਂ ਰੇਲਵੇ ਮਿਨਿਸਟਰ ਹਾਂ ਅਤੇ ਸਰ ਮਤਲਬ ਜਿਵੇਂ ਚਲੋ ਫਿਫਟੀ ਪ੍ਰਸੈਂਟ ਬਹੁਤ ਹੈ ਸਰ ਅਤੇ ਮਤਲਬ ਅਤੇ ਤੁਸੀਂ ਆਪਦਾ ਮਤਲਬ ਮੈਨੂੰ ਬੈਂਕ ਅਕਾਊਂਟ 'ਤੇ ਉਹ ਸਾਰਾ ਦੱਸ ਦਿਆ ਜੇ ਮਤਲਬ ਉਹਦੇ 'ਚ ਆ ਜਾਣਗੇ ਮਤਲਬ ਪੈਸੇ ਨਹੀਂ ਸਰ ਨਹੀਂ ਸਰ ਪੈਸੇ ਡਿਡਕਟ ਹੋਣਗੇ ਮਤਲਬ ਐਂਈ ਪੋਸਟਪੋਨ ਨਹੀਂ ਹੁੰਦੀ ਕੈਂਸਲ ਹੋਏਗੀ ਪਹਿਲਾਂ ਤੁਹਾਨੂੰ ਫਿਫਟੀ ਪ੍ਰਸੈਂਟ ਡਿਡਕਸ਼ਨ ਹੋਏਗੀ ਉਸ ਤੋਂ ਬਾਅਦ ਤੁਸੀਂ ਆਪੇ ਦੁਬਾਰਾ ਤੋਂ ਆਪੇ ਬੁੱਕ ਕਰ ਸਕਦੇ ਹੋ ਉਦੋਂ ਤੁਹਾਡੇ ਪੂਰੇ ਪੈਸੇ ਲੱਗਣਗੇ ਹੁਣ ਸਰ ਮਤਲਬ ਕੈਂਸਲ ਜਿਵੇਂ ਕਰੋਗੇ ਤਾਂ ਤੁਹਾਨੂੰ ਫਿਫਟੀ ਪ੍ਰਸੈਂਟ ਸਰ ਸਾਡੀ ਪੋਲਸੀ ਦੇ ਅੰਡਰ ਆਉਂਦਾ ਨਾ ਇਹ ਸਾਰਾ ਕੁਝ ਮੈਂ ਤੁਹਾਨੂੰ ਤੁਹਾਡੇ ਵਟਸਐਪ 'ਤੇ ਪੀਡੀਐਫ ਸੈਂਡ ਕਰਦਾ ਉਹ ਤੁਸੀਂ ਸਾਡੇ ਪੋਲਸੀ ਪੜ੍ਹ ਲਿਆ ਜੇ ਨਾ ਅਤੇ ਸਰ ਕੀ ਰੀਜ਼ਨ ਕੀ ਹੋ ਗਿਆ ਮਤਲਬ ਤੁਸੀਂ ਉਹ ਪੱਚੀ ਨਵੰਬਰ ਨੂੰ ਕਿਉਂ ਨਹੀਂ ਜਾ ਰਹੇ ਅੱਛਾ ਸਰ ਐਵੇਂ ਟਰੇਨਾਂ ਚਲਦੀਆਂ ਰਹਿੰਦੀਆਂ ਨੇ ਵੱਡੇ ਆ ਜਿਵੇਂ ਮੌਸਮ ਆ ਰਿਹਾ ਅਤੇ ਉਸ ਕਰਕੇ ਤੁਹਾਨੂੰ ਪਤਾ ਸੀਟਾਂ ਜਲਦੀ ਜੋ ਵੈਕੰਟ ਨਹੀਂ ਹੁੰਦੀਆਂ ਭਰੀਆਂ ਰਹਿੰਦੀਆਂ ਨੇ ਆਈ ਚੱਕਰ ਹੈ ਬਾਕੀ ਤੁਸੀਂ ਸਾਡੀ ਆਈਆਰਸੀਟੀਸੀ ਦੀ ਵੈਬਸਾਈਟ 'ਤੇ ਜਾਓਗੇ ਨਾ ਉਹ 'ਤੇ ਤੁਹਾਨੂੰ ਸ਼ੋ ਹੋਣ ਲੱਗ ਜੇਗਾ ਵੀ ਜਿਹੜੀ ਵੀ ਸੀਟ ਵੀਕੰਟ ਹੋਏਗੀ ਜਾਂ ਜਿੰਨੀ ਵੀ ਤਰੀਕ ਤੋਂ ਲੈ ਕੇ ਹੋਏਗੀ ਨਾ ਉਹ ਤੁਸੀਂ ਬੁੱਕ ਕਰ ਸਕਦੇ ਹੋ ਹਾਂ ਅਤੇ ਸਰ ਤੁਹਾਨੂੰ ਕਹਿ ਤਾ ਇੱਕ ਵਾਰੀ ਸਰ ਸਾਡੀ ਪੋਲਸੀ 'ਚ ਨਹੀਂ ਆਉਂਦਾ ਮੈਂ ਸਰ ਮੇਰੇ ਅੰਡਰ ਕੁਝ ਨਹੀਂ ਮੈਨੂੰ ਸਰਕਾਰ ਨੇ ਤਨਖਾਹ ਦੇ ਦੇਣੀ ਹੈ ਮਹੀਨੇ ਬਾਅਦ ਇਹ ਤਾਂ ਨਹੀਂ ਵੀ ਮੈਂ ਰੇਲਵੇ ਮਨਿਸਟਰ ਲੱਗਿਆ ਬਾਊ ਜੀ ਜਿਵੇਂ ਵੀ ਹੈ ਆਪਾਂ ਆਪ ਸਰਕਾਰੀ ਮੁਲਾਜ਼ਮ ਤੁਹਾਨੂੰ ਪਤਾ ਇਹ ਤਾਂ ਹੈ ਨਹੀਂ ਵੀ ਰੇਲਵੇ ਸਰ ਪ੍ਰਾਈਵੇਟ ਹੈ ਮੈਂ ਵੀ ਅਨਸਰ ਕੀ ਕਰ ਸਕਦਾ ਨਹੀਂ ਸਰ ਮੌਕੇ ਸਰ ਜਦ ਸੀਟਾਂ ਹੀ ਭਰ ਗਈਆਂ ਤਾਂ ਆਪਾਂ ਮੌਕੇ 'ਤੇ ਕਿਵੇਂ ਬੁੱਕ ਕਰ ਸਕਦੇ ਸਰ ਭਰ ਜਾਂਦੀਆਂ ਸੀਟਾਂ ਸਰ ਤੁਸੀਂ ਪਹਿਲਾਂ ਹੀ ਜੇ ਤੁਹਾਡਾ ਪਲੈਨ ਬਣੇ ਨਾ ਅੱਗੇ ਤੋਂ ਪਹਿਲਾਂ ਹੀ ਧਿਆਨ ਰੱਖਿਆ ਜੇ ਮਤਲਬ ਟਾਈਮ ਨਾਲ ਜਾਂ ਤੁਸੀਂ ਟਿਕਟ ਬੁੱਕ ਕਰਾ ਲਿਆ ਕਰੋ ਓ ਸਰ ਸਰ ਪਰ ਡਿਡਕਸ਼ਨ ਹੋਏਗੀ ਫਿਫਟੀ ਪ੍ਰਸੈਂਟ ਟੈਕਸ ਦਿੰਦਾ ਹੁੰਦਾ ਸਾਰਾ ਕੁਝ ਮਿਲਾ ਮੁਲਾ ਕੇ ਜੀ ਐਸ ਟੀ ਵਗੈਰਾ ਅਤੇ ਸਰ ਐਤਕੀ ਜਦੋਂ ਤੁਸੀਂ ਬੁੱਕ ਕਰਾਓ ਨਾ ਐਤਕੀ ਟਾਈਮ ਨਾਲ ਹੀ ਕਰਾ ਲਿਆ ਜੇ ਮਤਲਬ ਪਹਿਲਾਂ ਇੱਕ ਚੈੱਕ ਕਰ ਲਿਆ ਜੇ ਅਤੇ ਅੱਗੇ ਸੀਟਾਂ ਵੀਕੈਂਟ ਹੋਣੀਆਂ ਅਪਕਮਿੰਗ ਡੇਟ ਦੀਆਂ ਜਦੋਂ ਵੀ ਪੱਚੀ ਨਵੰਬਰ ਤੋਂ ਬਾਅਦ ਤੁਸੀਂ ਬੁੱਕ ਕਰਾਓਗੇ ਚੈੱਕ ਕਰ ਲਿਆ ਸਰ ਓਕੇ ਸਰ ਥੈਂਕ ਯੂ